ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਮੈਨੂੰ ਬਚਪਨ ਤੋਂ ਹੀ ਇਤਿਹਾਸ ਬਾਰੇ ਬਹੁਤ ਜ਼ਿਆਦਾ ਮਤਲਬ ਉਤਸੁਕਤਾ ਸੀ ਕਿ ਸ਼ੁਰੂ ਤੋਂ ਹੀ ਜਿਹੜਾ ਸਿੱਖ ਇਤਿਹਾਸ ਹੈ ਉਹ ਵੈਸੇ ਵੀ ਬਹੁਤ ਜ਼ਿਆਦਾ ਅਮੀਰ ਇਤਿਹਾਸ ਹੈ ਅਤੇ ਸ਼ੁਰੂ ਤੋਂ ਹੀ ਮੈਨੂੰ ਸਿੱਖਣ ਦੀ ਮਤਲਬ ਬਹੁਤ ਇੱਛਾ ਹੁੰਦੀ ਸੀਗੀ ਅਤੇ ਮੈਂ ਬਹੁਤ ਇਤਿਹਾਸਿਕ ਕਿਤਾਬਾਂ ਪੜ੍ਹੀਆਂ ਨੇ ਅਤੇ ਇੱਕ ਘਟਨਾ ਜਿਹੜੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਉਹ ਉਸ ਟਾਈਮ ਦੀ ਹੈ ਜਦੋਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀਗਾ ਅਤੇ ਉਹਨਾਂ ਨੂੰ ਨਾ ਤਾਂ ਕੁਛ ਖਾਣ ਨੂੰ ਦਿੱਤਾ ਜਾਂਦਾ ਸੀ ਅਤੇ ਇੱਕ ਸਾਡੇ ਗੁਰੂ ਪਿਆਰੇ ਹੋਏ ਸੀਗੇ ਜੀ ਮੋਤੀਰਾਮ ਮਹਿਰਾ ਜੀ ਜਿਹਨਾਂ ਨੇ ਫਿਰ ਚੋਰੀ ਜਾ ਕੇ ਉਹਨਾਂ ਨੂੰ ਦੁੱਧ ਛਕਾਇਆ ਸੀਗਾ ਠੰਡੇ ਬੁਰਜ ਦੇ ਵਿੱਚ ਅਤੇ ਆਪਣੇ ਪਰਿਵਾਰ ਦੀ ਜਾਂ ਆਪਣੀ ਨਾ ਪਰਵਾਹ ਕਰਦੇ ਹੋਏ ਵੀ ਉਹਨਾਂ ਨੇ ਜਾ ਕੇ ਉਹਨਾਂ ਨੂੰ ਪ੍ਰੇਮ ਭਾਵਨਾ ਦੇ ਨਾਲ ਦੁੱਧ ਛਕਾਇਆ ਅਤੇ ਬਾਅਦ ਵਿੱਚ ਜਿਹੜੇ ਮੋਤੀਰਾਮ ਮਹਿਰਾ ਜੀ ਸੀ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ